ਸਾਡੇ ਪਿੰਡ ਵਿੱਚ ਇੱਕ ਤਾਂ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ ਗਾ ਜੀ ਅਤੇ ਦੂਸਰਾ ਕੰਮ ਹੈਗਾ ਗਾ ਵੀ ਪਾਰਲਰ ਦਾ ਕੰਮ ਵੀ ਕੁੜੀਆਂ ਕਰਦੀਆਂ ਨੇ ਗੀਆਂ ਜਿਹੜੀ ਆਪਾਂ ਵੀ ਸਿਲਾਈ ਕਰਵਾਉਂਦੇ ਹਾਂ ਨਾਲ ਤਾਂ ਜਦੋਂ ਹੋਰ ਬਾਹਰ ਜਾ ਕੇ ਕਰਵਾਉਂਦੇ ਹਨ ਉਹਦੇ ਨਾਲ ਆਪਣੇ ਟਾਇਮ ਜ਼ਿਆਦਾ ਖਰਚ ਹੁੰਦਾ ਅਤੇ ਜਦੋਂ ਆਪਣੇ ਪਿੰਡ 'ਚ ਆਪਾਂ ਨੂੰ ਇਹੋ ਜਿਹੀ ਸਹੂਲਤ ਮਿਲਦੀ ਹੈ ਇਹਦੇ ਨਾਲ ਆਪਣਾ ਵੀ ਟਾਇਮ ਵੀ ਬਚਦਾ ਅਤੇ ਆਪਣਾ ਪੈਸਾ ਬਚਦਾ ਜਾਣ ਆਉਣ 'ਤੇ ਖਰਚ ਹੁੰਦਾ ਆਪਣਾ ਅਤੇ ਦੂਸਰਾ ਜਿਹੜਾ ਪਾਰਲਰ ਦਾ ਕੰਮ ਆਪਣਾ ਉਹ ਵੀ ਕੁੜੀਆਂ ਕਰਦੀਆਂ ਨੇ ਗੀਆਂ ਉਹਦੇ ਨਾਲ ਵੀ ਆਪਣਾ ਟਾਇਮ ਵੀ ਬਚਦਾ ਅਤੇ ਆਪਣਾ ਪੈਸਾ ਵੀ ਬਚਦਾ ਅਤੇ ਨਾਲ ਉਨ੍ਹਾਂ ਨੂੰ ਵੀ ਰੁਜ਼ਗਾਰ ਮਿਲਦਾ ਗਾ ਜਦੋਂ ਆਪਾਂ ਬਾਹਰੋਂ ਸਿਲਾਈ ਕਢਾਈ ਕਰਵਾਉਂਦੇ ਹਾਂ ਤਾਂ ਉਹ ਆਪਾਂ ਨੂੰ ਲੰ ਟਾਇਮ ਵੀ ਲੰਬਾ ਦੇ ਦਿੰਦੇ ਹੈ ਕਿ ਵੀ ਐਟ ਏ ਟੈਮ ਨਹੀਂ ਤਿਆਰ ਕਰਕੇ ਦਿੰਦੇ ਜਦੋਂ ਆਪਾਂ ਨੂੰ ਲੋੜ ਹੁੰਦੀ ਹੈਗੀ ਕੱਪੜਿਆਂ ਦੀ ਜਾਂ ਹੋਰ ਕਿਸੇ ਵੀ ਚੀਜ਼ ਦੀ ਜਿਹੜੀ ਪਾਰਲਰ ਵਾਲੀਆਂ ਜੇ ਆਪਾਂ ਨੂੰ ਥੋ ਛੋਟਾ ਮੋਟਾ ਕਿਸੇ ਫ਼ੰਕਸ਼ਨ 'ਤੇ ਜਾਣਾ ਗਾ ਤਾਂ ਆਪਾਂ ਪਿੰਡ 'ਚ ਜਾ ਕੇ ਜਲਦੀ ਕਰਵਾ ਕੇ ਵਾਪਸ ਆ ਕੇ ਅਤੇ ਆਪਾਂ ਆਪਣੇ ਫ਼ੰਕਸ਼ਨ ਨੂੰ ਅਟੈਂਡ ਕਰ ਸਕਦੇ ਐਂਗੇ ਜਿਹੜੇ ਵੀ ਜਦੋਂ ਇਹ ਰੁਜ਼ਗਾਰ ਦੇਖਦੇ ਹੈਗੇ ਬੰ ਆਪਣੇ ਆਪ ਸੈਲਫ ਡਪੈਂਡ ਵੀ ਹੋ ਜਾਂਦੇ ਹੈਗੇ ਇਹਦੇ ਨਾਲ ਅਤੇ ਨਾਲ ਆਪਦਾ ਘਰ ਦਾ ਘਰ ਰਹਿੰਦੇ ਹੈਗੇ ਅਤੇ ਆਪਣੇ ਘਰ ਦਾ ਕੰਮ ਵੀ ਦੇਖਦੇ ਆ ਆਪਣੇ ਬੱਚਿਆਂ ਦੀ ਦੇਖਭਾਲ ਵੀ ਦੇਖਦੇ ਹੈਗੇ ਅਤੇ ਨਾਲ ਉਹ ਆਪਣਾ ਇਹ ਰੁਜ਼ਗਾਰ ਚਲਾਉਂਦੇ ਨੇਗੇ ਅਤੇ ਇਸ ਰੁਜ਼ਗਾਰ ਨੂੰ ਦੇਖ ਕੇ ਉਨ੍ਹਾਂ ਨੂੰ ਕੋਈ ਹੋਰ ਵੀ ਦੂਜਿਆਂ ਨੂੰ ਵੀ ਇਹ ਲੱਗਦਾ ਗਾ ਵੀ ਅਸੀਂ ਵੀ ਇਸ ਕੰਮ ਨੂੰ ਅੱਗੇ ਤੋਰੀਏ ਅਤੇ ਅਸੀਂ ਵੀ ਰੁਜ਼ਗਾਰ ਕਮਾਈਏ ਅਤੇ ਆਪਣੇ ਪੈਰਾਂ 'ਤੇ ਸੈਲਫ ਡਪੈਂਡ ਹੋ ਜਾਈ